ਨਹੀਂ ਖਾਣਾ ਬਣਾਉਣਾ ਸਿਰਫ਼ ਔਰਤਾਂ ਦਾ ਕੰਮ ਨਹੀਂ ਹਨ ਮ ਮਰਦ ਵੀ ਖਾਣਾ ਬਣਾ ਲੈਂਦੇ ਹਨ ਜਿਸ ਤਰ੍ਹਾਂ ਕਿ ਮੇਰਾ ਬ੍ਰਦਰ ਉਹ ਜਦੋਂ ਅਸੀਂ ਕਿਸੇ ਟਾਈਮ ਨਾ ਘਰ ਹੋਈਏ ਉਹ ਬਹੁਤ ਹੀ ਵਧੀਆ ਮੈਗੀ ਬਣਾ ਲੈਂਦਾ ਵਾ ਚਾਹ ਬਣਾ ਲੈਂਦਾ ਵਾ ਮਿੱਠੀਆਂ ਦੁੱਧ ਵਾਲੀਆਂ ਸੇਵੀਆਂ ਵੀ ਬਣਾ ਲੈਂਦਾ ਵਾ ਬਹੁਤ ਵਧੀਆ ਖਾਣਾ ਬਣਾ ਲੈਂਦਾ ਵਾ ਇਸ ਟਕ ਇਸ ਤਰ੍ਹਾਂ ਉਹ ਕਿਸੇ ਟਾਈਮ ਅਸੀਂ ਨਾ ਘਰ ਹੋਈਏ ਉਹ ਭੁੱਖੇ ਨਹੀਂ ਰਹਿੰਦੇ ਉਹ ਕਿਸੇ ਟਾਈਮ 'ਤੇ ਵਧੀਆ ਉਹ ਸਬਜ਼ੀ ਨੂੰ ਵੀ ਤੜਕਾ ਲਾ ਲੈਂਦਾ ਵਾ ਅਤੇ ਇਸ ਤਰ੍ਹਾਂ ਕਈ ਸਾਡੇ ਘਰ ਵਿੱਚ ਚੰਗੇ ਮੈਂਬਰ ਹਨ ਕਿ ਜਿਹੜੇ ਵਧੀਆ ਖਾਣਾ ਬਣਾ ਲੈਂਦੇ ਜਿਸ ਤਰ੍ਹਾਂ ਮੇਰਾ ਬ੍ਰਦਰ ਹੋ ਗਿਆ ਮੇਰਾ ਚਾਚੂ ਹੋ ਗਿਆ ਜਿਸ ਤਰ੍ਹਾਂ ਚਾਚੂ ਮੇਰੇ ਹਲਵਾਈ ਦਾ ਕੰਮ ਕਰਦੇ ਹਨ ਉਹ ਬਹੁਤ ਵਧੀਆ ਮੈਰਿਜ ਵਿੱਚ ਖਾਣਾ ਬਣਾਉਂਦੇ ਹਨ ਬਹੁਤ ਵਧੀਆ ਬਹੁਤ ਟੇਸਟ ਪਕੌੜੇ ਬਣਾਉਂਦੇ ਹਨ ਬ ਸਬਜ਼ੀਆਂ ਵੀ ਬੜੀਆਂ ਟੇਸਟ ਬਣਾਉਂਦੇ ਹਨ ਜਿਸ ਤਰ੍ਹਾਂ ਸ਼ੈਫ ਖਾਣਾ ਬਣਾਉਂਦੇ ਹਨ ਇਸ ਤਰ੍ਹਾਂ ਹੀ ਵਿਆਹਾਂ ਵਿੱਚ ਮੇਰੇ ਚਾਚੂ ਵੀ ਖਾਣਾ ਬਣਾਉਂਦੇ ਹਨ ਉਹ ਬਹੁਤ ਵਧੀਆ ਖਾਣਾ ਬਣਾਉਂਦੇ ਹਨ ਅਤੇ ਖਾਣਾ ਬਣਾਉਣਾ ਸਿਰਫ਼ ਔਰਤਾਂ ਦਾ ਕੰਮ ਨਹੀਂ ਹੈਗਾ ਬਹੁਤ ਹੀ ਸਵਾਦ ਖਾਣਾ ਜਿਸ ਤਰ੍ਹਾਂ ਮੈਂ ਬਣਾਉਂਦੀ ਆ ਚਾਵਲ ਬਣਾਉਂਦੀ ਆ ਪਨੀਰ ਦੀ ਸਬਜ਼ੀ ਬਹੁਤ ਵਧੀਆ ਬਣਾਉਂਦੀ ਹਾਂ ਅਤੇ ਖਾਣਾ ਬਣਾਉਣਾ ਬਹੁਤ ਵਧੀਆ ਹੈ ਲੱਗਦਾ ਹੈ ਸਾਨੂੰ